ਮੈਂ ਖਬਰਾਂ ਬਹੁਤ ਸ਼ੌਂਕ ਨਾਲ ਪੜਦੀ ਹਾਂ ਸਵੇਰੇ ਉਠਦੇ ਹੀ ਮੇਰੇ ਦਿਨ ਚਰਿਆ ਅਖਬਾਰ ਨਾਲ ਹੀ ਸ਼ੁਰੂ ਹੁੰਦੀ ਹੈ ਚਾਹ ਦਾ ਕੱਪ ਨਾਲ ਰੱਖ ਕੇ ਮੈਂ ਅਖਬਾਰ ਪੜਦੀ ਹਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਆਪਣੇ ਦੇਸ਼ ਵਿੱਚ ਕੀ ਵਾਪਰ ਰਿਹਾ ਉਹ ਦੇਖਣਾ ਪਸੰਦ ਹੈਗਾ ਫਿਰ ਉਸ ਤੋਂ ਬਾਅਦ ਸਾਰਿਆਂ ਹੋਰ ਅਖਬਾਰ ਪੜਦੀ ਹਾਂ ਸਭ ਤੋਂ ਵਧੀਆ ਮੈਨੂੰ ਮੰਨੋਰੰਜਨ ਲੱਗਦਾ ਹੈ ਮੈਨੂੰ ਪਿਕਚਰਾਂ ਦੇ ਬਾਰੇ ਸੁਣਨਾ ਪੜਨਾ ਬਹੁਤ ਮਜ਼ਾ ਆਉਂਦਾ ਹੈ ਹਰ ਐਕਟਰ ਐਕਟਰੈਸ ਦੇ ਬਾਰੇ ਪਤਾ ਲੱਗੇ ਕੀ ਚੱਲ ਰਿਹਾ ਹੈ ਕਿਹਦਾ ਬੇਟਾ ਹੋਇਆ ਹੈ ਕਿਹਦਾ ਵਿਆਹ ਹੋ ਰਿਹਾ ਕਿਹਦੇ ਨਾਲੋਂ ਉਹਦੀ ਚੱਲ ਰਹੀ ਹੈ ਸਭ ਕੁਝ ਬਹੁਤ ਪਸੰਦ ਹੈ ਮੈਂ ਦਿਨ ਦੇ ਵਿੱਚ ਵੀ ਅਖਬਾਰ ਕੱਢ ਕੇ ਦੁਬਾਰਾ ਦੇਖਦੀ ਹਾਂ ਕਿ ਕੋਈ ਵਧੀਆ ਖਬਰ ਮੇਰੀ ਰਹਿ ਤਾਂ ਨਹੀਂ ਗਈ ਸਭ ਦੇ ਬਾਰੇ ਸਭ ਕੁਝ ਜਾਣਨਾ ਚਾਹੁੰਦੀ ਹਾਂ ਥੋੜੇ ਥੋੜਾ ਟਾਈਮ ਦੇ ਕੇ ਪੜਦੀ ਰਹਿੰਦੀ ਹਾਂ ਇਸ ਬਾਰੇ ਜਿਆਦਾ ਤਾਂ ਨਹੀਂ ਪਰ ਸਾਰੇ ਦੁਨੀਆਂ ਦੇ ਬਾਰੇ ਵੀ ਪਤਾ ਲੱਗਦਾ ਰਹਿੰਦਾ ਹੈ ਕੀ ਹੋ ਰਿਹਾ ਐ ਦੂਸਰੇ ਦੇਸ਼ਾਂ 'ਚ ਤਾਂ ਕੀ ਹੋ ਰਿਹਾ ਸਾਡੇ ਦੇਸ਼ਾਂ ਵਿੱਚ ਮੈਨੂੰ ਸਭ ਤੋਂ ਜਿਆਦਾ ਪਸੰਦ ਹੈ ਜਾਨਣਾ ਔਰ ਇਸੀ ਲਈ ਮੈਂ ਅਖਬਾਰ ਨੂੰ ਸਾਰਾ ਦਿਨ ਵੀ ਪੜ੍ਹ ਸਕਦੀ ਹਾਂ ਵੈਸੇ ਮੈਂ ਥੋੜੀ ਦੇਰ ਹੀ ਪੜ੍ਹ ਸਕਦੀ ਹਾਂ ਕਿਉਂਕਿ ਕੰਮ ਦਾ ਟਾਈਮ ਹੁੰਦੇ ਨੇ ਤਾਂ ਉਹਦੇ ਲਈ ਘੱਟ ਟਾਈਮ ਹੁੰਦਾ ਹੈ